ਜਿੱਦਾਂ ਆਪਾਂ ਦੇਖਿਆ ਜਾਵੇ ਜਿਹੜਾ ਹੁਣ ਦਾ ਜਿਹੜਾ ਭਾਰਤ ਦਾ ਅਰਥ 'ਚ ਅਰਥ 'ਚ ਅਰਥ ਵਿਵਸਥਾ ਹੈਗੀ ਹੈ ਉਹਨੂੰ ਜਿਹੜਾ ਵਿਕਾਸ ਵਿੱਚ ਜਿਹੜਾ ਮੇਨ ਯੋਗਦਾਨ ਹੈਗਾ ਹੈ ਉਹ ਪਾਇਆ ਹੈ ਇੱਥੇ ਦੇ ਇੰਡਸਟਰੀਲਾਈਜੇਸ਼ਨ ਨੇ ਕਿਉਂਕਿ ਜਿਹੜਾ ਜਿੱਦਾਂ ਹੁਣ ਜਿੱਥੇ ਜਿਹੜਾ ਕੋਈ ਵੀ ਹੈਗੀ ਹੈ ਕਿਸੇ ਵੀ ਦੇਸ਼ ਦੀ ਜਿਹੜਾ ਉਹਨੂੰ ਉਹਦੀ ਇਕਨੋਮਿਕ ਪਾਵਰ ਬਣਾਉਣ ਵਾਲੀ ਹੁੰਦੀ ਹੈਗੀ ਉੱਥੇ ਦੀ ਜਿਹੜੀ ਹੁੰਦੀ ਹੈਗੀ ਹੈ ਅਰਥ ਵਿਵਸਥਾ ਉਹਦੀ ਜੀ ਡੀ ਪੀ ਰੇਟ ਵਗੈਰਾ ਜਿਹੜੇ ਹੁਣ ਆਪਾਂ ਪਿੱਛੇ ਪਿੱਛੇ ਜੇ ਦੇਖਿਆ ਜਾਵੇ ਜੇ ਆਪਾਂ ਜਿਹੜਾ ਉਹ ਅਦਰ ਕੋਈ ਵੀ ਕੰਟਰੀ ਸੀਗੀ ਕਰੋਨਾ ਕਾਲ ਵਿੱਚ ਸਾਰਿਆਂ ਦੀ ਜਿਹੜੀ ਹੈਗੀ ਸੀ ਜਿਹੜੀ ਅਰਥ ਵਿਵਸਥਾ ਸੀਗੀ ਜੀ ਡੀ ਪੀ ਰੇਟ ਸੀਗਾ ਸਾਰੀਆਂ ਕੰਟਰੀਆਂ ਦਾ ਘੱਟਿਆ ਸੀਗਾ ਅਤੇ ਜਿਹੜਾ ਇੰਡੀਆ ਹੈ ਇੰਡੀਆ ਦਾ ਜਿਹੜਾ ਜੀ ਡੀ ਪੀ ਰੇਟ ਹੈਗਾ ਸਿਕਸ ਪੁਆਇੰਟ ਸੈਵਨ ਪ੍ਰਸੈਂਟ ਦੇ ਅਕੋਡਿੰਗ ਉਹ ਵਧਿਆ ਹੈਗਾ ਹੈ ਇਸ ਤਰ੍ਹਾਂ ਦੇਖਿਆ ਜਾਵੇ ਆਪਾਂ ਜਿਹੜੀ ਕੋਈ ਵੀ ਹੈਗੀ ਹੈ ਜਿਹੜੀ ਉੱਥੇ ਦੇਸ਼ ਹੈਗਾ ਹੈ ਉਹਦੀ ਜਿਹੜੀ ਅਰਥ ਵਿਵਸਥਾ ਨੂੰ ਚਲਾਉਣ ਵਾਸਤੇ ਇੰਡਸ ਇੰਡਸਟਰੀਲਾਈਜੇਸ਼ਨ ਇੱਕ ਬਹੁਤ ਵਧੀਆ ਰੋਲ ਅਦਾ ਕਰਦੀ ਹੈਗੀ ਹੈ ਇਹ ਤੋਂ ਇਲਾਵਾ ਜਿਹੜਾ ਦੂਜਾ ਹੈ ਜਿਹੜਾ ਜਿਹੜਾ ਕਰੋਨਾ ਕਾਲ ਵਿੱਚ ਸਾਰਾ ਤੋਂ ਜ਼ਿਆਦਾ ਮੋਹਰੇ ਉੱਭਰ ਕੇ ਆਇਆ ਹੈਗਾ ਹੈ ਪੁਰਾਣੇ ਸਮੇਂ ਦੇ ਅਕੋਡਿੰਗ ਉਹ ਹੈਗਾ ਇੱਕ ਔਨਲਾਈਨ ਟੀਚਿੰਗ ਪਲੈਟਫੋਮ ਜਿਹੜਾ ਔਨਲਾਈਨ ਜਿਹੜਾ ਟੀਚਿੰਗ ਪਲੈਟਫੋਮ ਹੈਗਾ ਹੈ ਉਹ ਆਪਾਂ ਪੁੱਛਿਆ ਜਾਵੇ ਪਿਛਲੇ ਜੇ ਕੁਛ ਸਾਲਾਂ ਦੇ ਅਕੋਡਿੰਗ ਜੇ ਹੁਣ ਕੰਮਪੇਅਰ ਕੰਮਪੇਅਰ ਕੀਤਾ ਜਾਵੇ ਉਹਨੂੰ ਤਾਂ ਉਹ ਇੱਕ ਬਿਲੀਅਨ ਡੌਲਰ ਦੇ ਜਿਹੜਾ ਇੱਕ ਹੈਗਾ ਉਹ ਉਦਯੋਗ ਹੈਗਾ ਹੈ ਉਹ ਬਣ ਕੇ ਆਇਆ ਹੈਗਾ ਬਣ ਕੇ ਉੱਭਰਿਆ ਹੈਗਾ ਹੈ ਸਾਹਮਣੇ ਆਇਆ ਹੈਗਾ ਹੈ ਉਹਦੇ ਇਲਾਵਾ ਇਹਨੇ ਜਿਹੜੀ ਇੰਟਰਨੈੱਟ ਬੈਂਕਿੰਗ ਡਿਜੀਟਲ ਭੁਗਤਾਨ ਇਹਨੇ ਵੀ ਇਹਨੇ ਇਹਨੇ ਵੀ ਹੁਣ ਜਿਹੜੇ ਹੈਗੇ ਹੈ ਆਉਣ ਵਾਲੇ ਮਤਲਬ ਹੁਣ ਜਿਹੜੇ ਬੀਤੇ ਕੁਛ ਸਾਲਾਂ 'ਚ ਇਹਨੇ ਕਾਫ਼ੀ ਤਰੱਕੀ ਕੀਤੀ ਹੈਗੀ ਹੈ